ਮੈਨੂੰ ਮੇਰੀ ਮੰਜ਼ਿਲ 'ਤੇ ਛੱਡਣ ਲਈ ਤੁਹਾਡਾ ਧੰਨਵਾਦ ਅਤੇ ਮੈਂ ਮਾਫ਼ੀ ਚਾਹੁੰਦੀ ਹਾਂ ਕਿ ਮੈਂ ਆਪਣਾ ਪੈਸਿਆਂ ਵਾਲ਼ਾ ਪਰਸ ਘਰ ਭੁੱਲ ਆਈ ਹਾਂ ਅਤੇ ਉਸਦੀ ਜਗ੍ਹਾ ਮੈਂ ਦੂਜਾ ਪਰਸ ਲੈ ਆਈ ਹਾਂ ਜਿਸ ਵਿੱਚ ਖੁੱਲ੍ਹੇ ਪੈਸੇ ਨਹੀਂ ਹਨ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੈਂ ਤੁਹਾਨੂੰ ਪੇਟੀਐੱਮ ਗੂਗਲ ਪੇ ਰਾਹੀਂ ਪੈਸੇ ਭੇਜ ਸਕਦੀ ਹਾਂ ਤੁਸੀਂ ਮੈਨੂੰ ਮੇਰਾ ਕੁੱਲ ਖਰਚਾ ਵੀ ਦੱਸ ਦਿਓ ਤਾਂ ਜੋ ਮੈਂ ਤੁਹਾਨੂੰ ਉਨੇ ਪੈਸੇ ਭੇਜ ਸਕਾਂ ਅਤੇ ਮੈਨੂੰ ਤੁਹਾਡੇ ਗੂਗਲ ਪੇ ਪਿੰਨ ਜਾਂ ਮੋਬਾਈਲ ਨੰਬਰ ਦੀ ਜ਼ਰੂਰਤ ਹੈ